ਜੇਕਰ ਕਿਸੇ ਖੇਤਰ ਦੀ ਪਹਿਚਾਣ ਕਰਨੀ ਹੈ ਜਾਂ ਉਸ ਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਉੱਥੋਂ ਦੀਆਂ ਖੇਡਾਂ ਬਾਰੇ ਉਸ ਦੀਆਂ ਖੇਡਾਂ ਦੀ ਜਾਣਕਾਰੀ ਲਈ ਜਾਵੇ ਤਾਂ ਉਸ ਉਸ ਨਾਲ ਕੀ ਹੁੰਦਾ ਹੈ ਕਿ ਆਪਾਂ ਆਪਾਂ ਇਹ ਜਾਣ ਸਕਦੇ ਹਾਂ ਕਿ ਉੱਥੋਂ ਦੇ ਲੋਕਾਂ ਦੀ ਕੀ ਸੋਚ ਹੈ ਕਿਉਂਕਿ ਖੇਡਾਂ ਉਸ ਢੰਗ ਨਾਲ ਹੀ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਕਿ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਤਾਂ ਕਿ ਉਹ ਜਿੰਦਗੀ ਦੇ ਵਿੱਚ ਅੱਗੇ ਵਧ ਸਕਣ ਤਾਂ ਕਿ ਜਿਵੇਂ ਕਿ ਕਈ ਜਗ੍ਹਾ ਦੇ ਉੱਤੇ ਮੇਨ ਜੋ ਫੋਕਸ ਕੀਤਾ ਜਾਂਦਾ ਹੈ ਖੇਡਾਂ ਖੇਡਾਂ ਦੇ ਵਿੱਚ ਲੈ ਕੇ ਉਹ ਜ਼ਿਆਦਾਤਰ ਸਾਰੀ ਇੱਕ ਬਲ ਦੇ ਉੱਤੇ ਕੀਤਾ ਜਾਂਦਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਕਬੱਡੀ ਜਾਂ ਗੱਤਕਾ ਲੈ ਸਕਦੇ ਹਾਂ ਜਿਸ ਨਾਲ ਇੱਥੋਂ ਦੀ ਲੋਕਾਂ ਦੀ ਸੋਚ ਦਾ ਪਤਾ ਚੱਲਦਾ ਹੈ ਕਿ ਵੀ ਉਹ ਕੀ ਸੋਚ ਰਹੇ ਹਨ ਉਹਨਾਂ ਦਾ ਕੀ ਮੰਤਵ ਹੈ ਉਹ ਕੀ ਚਾਹੁੰਦੇ ਹਨ ਕਿ ਇੱਥੋਂ ਦੇ ਬੱਚੇ ਕੀ ਸਿੱਖਣ ਖੇਡਾਂ ਦੇ ਨਾਲ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਆਪਣੀ ਪਹਿਚਾਣ ਬਣਾ ਸਕਣ ਉਸ ਤਰ੍ਹਾਂ ਖੇਡਾਂ ਖੇਤਰਾਂ ਦੀ ਸੱਭਿਆਚਾਰਕ ਪਹਿਚਾਣ ਨੂੰ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ ਦਿੰਦੀਆਂ ਹਨ ਜਿਵੇਂ ਕਿ ਖੇਡਾਂ ਖੇਡਾਂ ਦੇ ਨਾਲ ਕਿਸੇ ਵੀ ਖੇਤਰ ਦਾ ਸੱਭਿਆਚਾਰ ਬਚਿਆ ਰਹਿੰਦਾ ਹੈ ਅਤੇ ਉਹ ਉਹ ਬੱਚਿਆਂ ਨੂੰ ਜਾ ਜਾ ਕੇ ਕਿਸੇ ਵੀ ਪ੍ਰਕਾਰ ਦੇ ਲੋਕਾਂ ਨੂੰ ਉਤਸ਼ਾਹਿਤ ਕਰਦੀਆਂ ਹਨ ਤਾਂ ਕਿ ਖੇਡਾਂ ਰਾਹੀਂ ਉਹ ਉਹ ਖੇਡਾਂ ਰਾਹੀਂ ਆਪਣਾ ਕੰਮ ਕਰ ਸਕਣ ਆਪਣਾ ਮਤਲਬ ਮਨੋਰੰਜਨ ਕਰ ਸਕਣ ਅਤੇ ਜ਼ਿੰਦਗੀ ਦੇ ਬਾਰੇ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਣ